ਭੰਗੜਾ ਸ ਸਾਡੇ ਵਾਸਤੇ ਬਹੁਤ ਹੀ ਜ਼ਰੂਰੀ ਹੈ ਹਿੱਸਾ ਹੈ ਭੰਗੜੇ ਦੇ ਨਾਲ ਅਸੀਂ ਇਹ ਸਾਡੀ ਸੇ ਸਿਹਤ ਵੀ ਬਹੁਤ ਚੰਗੀ ਰਹਿੰਦੀ ਹੈ ਭੰਗੜੇ ਨਾਲ ਸਾਨੂੰ ਹਰੇ ਹਰੇਕ ਸਰੀਰ ਦੇ ਵਿੱਚ ਐਕਸਰਸਾਈਜ਼ ਹੁੰਦੀ ਹੈ ਭੰਗੜੇ ਨੂੰ ਅਸੀਂ ਭੰਗੜੇ ਨੂੰ ਵਿਕਲਪਾਂ ਹੋਰ ਬਾਕੀ ਵਿਕਲਪਾਂ ਵਾਸਤੇ ਭੰਗੜਾ ਬਹੁਤ ਹੀ ਵਧੀਆ ਹੈ ਅਤੇ ਇਹ ਯਾਨੀ ਕਿ ਸਸਤਾ ਅਸੀਂ ਕਿਸੇ ਪੈਸੇ ਖਰਚਣ ਦੀ ਲੋੜ ਨਹੀਂ ਹੁੰਦੀ ਇਹਦੇ ਨਾਲ ਅਸੀਂ ਜਿਮ ਵੀ ਕਿਸੇ ਪਾਸੇ ਜਿੰਮ ਨਹੀਂ ਜਾ ਸਕਦੇ ਜਿੰਮਾਂ ਜਿੰਮਾਂ ਦੇ ਅਸੀਂ ਇਹਨਾਂ ਪੈਸਾ ਵੇਸਟ ਕਰਦੇ ਹਾਂ ਅਤੇ ਅਸੀਂ ਯਾਨੀ ਕਿ ਬਿਨਾਂ ਪੈਸੇ ਤੋਂ ਆਪਣੀ ਇਸ ਸਿਹਤ ਦੀ ਸ ਸੰਭਾਲ ਕਰ ਸਕਦੇ ਹਾਂ ਸ ਸਿਹਤ ਦੀ ਐਕਸਰਸਾਈਜ਼ ਇੰਨੀ ਹੁੰਦੀ ਹੈ ਸਾਰੀ ਅੰਗਾਂ ਦੀ ਸਾਡੀ ਯਾਨੀ ਕਿ ਸਹੀ ਰਹਿੰਦੇ ਹਨ ਭੰਗੜਾ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੈ ਭੰਗੜੇ ਨੂੰ ਅਸੀਂ ਬਹੁਤ ਹੀ ਨਾਲ ਮੰਨੋਰੰਜਨ ਦਾ ਸਾਧਨ ਹੈ ਨਾਲ ਹੀ ਅਸੀਂ ਇਹਦੀ ਮੰਨੋਰੰਜਨ ਦਾ ਸਾਧਨ ਹੈ ਭੰਗੜਾ ਭੰਗੜਾ ਸਾਡੀ ਸ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ ਇਹਦੇ ਨਾਲ ਅਸੀਂ ਬਹੁਤ ਹੀ ਕਸਰਤ ਸਹੀ ਸਹੀ ਹੋ ਜਾਂਦੀ ਹੈ ਅਤੇ ਨਾਲ ਇਹ ਪੈਸੇ ਦਾ ਵੀ ਸਾਧਨ ਹੈ ਭੰਗੜਾ ਨਾਲ ਹੀ ਕਰਦੇ ਹਾਂ ਇਹ ਕਿਤੇ ਬਾਹਰ ਜਾ ਕੇ ਭੰਗੜਾ ਅਸੀਂ ਪਾਉਂਦੇ ਵੀ ਹਾਂ ਅਤੇ ਸਾਨੂੰ ਉਹਦੇ ਨਾਲ ਸਾਡਾ ਸਰੀਰ ਫਿਟ ਰਹਿੰਦਾ ਹੈ ਅਤੇ ਨਾਲੇ ਵੈਸੇ ਵੀ ਸਾਨੂੰ ਇਹ ਆ ਜਾਂਦੇ ਹਨ ਭੰਗੜਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਅਤੇ ਬਾਕੀ ਇ ਗੇਮਾਂ ਦੇ ਵਿੱਚ ਬਾਕੀ ਦੇ ਮੁਕਾਬਲੇ ਭੰਗੜਾ ਸਾਡੇ ਲਈ ਬਹੁਤ ਜ਼ਰੂਰੀ ਹੈ ਇਹਦੇ ਨਾਲ ਅਸੀਂ ਫਰੀ ਰਹਿੰਦੇ ਹਾਂ ਆਪਣਾ ਸਿਹਤ ਦੀ ਸੰਭਾਲ ਵਧੀਆ ਹੁੰਦੀ ਹੈ ਸਾਡਾ ਸਰੀਰ ਫਿਟ ਰਹਿੰਦਾ ਹੈ ਇਸ ਕਰਕੇ ਇਹਨੂੰ ਸਾਨੂੰ ਭੰਗੜਾ ਬਹੁਤ ਜ਼ਰੂਰੀ ਹੈ ਭੰਗੜੇ ਵਾਸਤੇ ਅਸੀਂ ਕਰਨਾ ਚਾਹੀਦਾ ਸਾਨੂੰ ਅਤੇ ਨਾਲ ਸਾਨੂੰ ਸ ਐਕਸਰਸਾਈਜ਼ ਹੁੰਦੀ ਹੈ ਇਹ ਸਾਡੇ ਵਾਸਤੇ ਸਿਹਤ ਵਾਸਤੇ ਬਹੁਤ ਹੀ ਜ਼ਰੂਰੀ ਹੈ